ਮੇਰੇ ਇਲਾਕੇ ਵਿੱਚ ਪੰਜਾਬ ਕੇਸਰੀ ਅਖਬਾਰ ਉਪਲਬਧ ਹੈ ਅਤੇ ਮੈਂ ਇਸ ਅਖਬਾਰ ਦਾ ਗਾਹਕ ਹਾਂ ਅਤੇ ਇਹ ਅਖਬਾਰ ਵਿੱਚ ਖੇਡਾਂ ਵਾਲਾ ਮੇਰਾ ਮਨਪਸੰਦ ਕੋਲਮ ਹੈ